ਸਿਰ ਦਰਦ ਤੋਂ ਤੁਰੰਤ ਛੁਟਕਾਰਾ ਪਾਉਣ ਲਈ ਪਾਣੀ ਜਾਂ ਇਲੈਕਟਰਾਈਟ ਡਰਿੰਕ ਪੀਓ ਸਿਰ ਦੀ ਮਾਲਿਸ਼ ਕਰੋ ਪੁਦੀਨੇ ਦੀ ਚਾਹ ਪੀਓ ਜਾਂ ਪੁਦੀਨੇ ਦਾ ਰਸ ਮੱਥੇ 'ਤੇ ਲਗਾਓ ਅਦਰਕ ਦਾ ਸੇਵਨ ਕਰੋ ਤੁਲਸੀ ਦੇ ਪੱਤਿਆਂ ਨੂੰ ਉਭਾਲ ਕੇ ਚਾਹ ਦੀ ਤਰ੍ਹਾਂ ਪੀਓ ਬਦਾਮ ਖਾਓ ਪੈਰਾਂ ਨੂੰ ਗਰਮ ਪਾਣੀ ਵਿੱਚ ਡਬੋ ਦਿਓ ਠੰਡਾ ਅਪ੍ਰਿੰਨ ਲਗਾਓ ਜਾਂ ਸਿਰ 'ਤੇ ਬਰਫ ਲਪੇਟੋ ਉਹਨਾਂ ਚੀਜ਼ਾਂ ਨੂੰ ਹਟਾਓ ਜੋ ਤੁਹਾਡੇ ਸਿਰ 'ਤੇ ਦਬਾਵ ਪਾਉਂਦੀਆਂ ਹਨ ਜਿਵੇਂ ਕਿ ਪੋਨੀਟੇਲ ਬਸ ਟੋਪੀਆਂ ਹੈਡਫੋਨ ਚੰਗੀ ਨੀਂਦ ਲਓ ਅਤੇ ਸੋਣ ਅਤੇ ਜਾਗਣ ਦਾ ਸਮਾਂ ਇੱਕੋ ਜਿਹਾ ਰੱਖੋ ਨਿਯਮਿਤ ਤੋਰ 'ਤੇ ਕਸਰਤ ਕਰੋ ਯੋਗਾ ਕਰੋ ਜਾਂ ਧਿਆਨ ਕਰੋ ਆਪਣੀ ਖੁਰਾਕ ਵਿੱਚ ਮੈਗਨੀਸ਼ੀਅਮ ਸ਼ਾਮਿਲ ਕਰੋ ਵਧੀਆ ਤਰੀਕੇ ਨਾਲ ਖੁਰਾਕ ਖਾਓ ਅਤੇ ਆਪਣੇ ਸਰੀਰ ਦਾ ਧਿਆਨ ਰੱਖੋ